ਭੰਗੜਾ ਪੰਜਾਬੀ ਲੋਕ ਨਾਚ ਹੈ ਜੋ ਸਿਰਫ ਸਰੀਰਕ ਫਾਇਦੇ ਹੀ ਨਹੀਂ ਦਿੰਦਾ ਸਗੋਂ ਮਾਨਸਿਕ ਸਿਹਤ ਲਈ ਵੀ ਬਹੁਤ ਵਧੀਆ ਹੈ ਇਸਨੂੰ ਕਰਨ ਨਾਲ ਸਰੀਰ ਵਿੱਚ ਐਂਡਫਰਿੰਨ ਰਿਲੀਜ਼ ਹੁੰਦੇ ਹਨ ਜੋ ਕਿ ਤੁਹਾਡੇ ਮੂਡ ਨੂੰ ਸਹੀ ਰੱਖਣ ਵਿੱਚ ਮਦਦ ਕਰਦੇ ਹਨ ਜਦੋਂ ਤੁਸੀਂ ਭੰਗੜਾ ਕਰਦੇ ਹੋ ਤਾਂ ਇਹ ਮਾਨਸਿਕ ਤਣਾਅ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ ਅਤੇ ਸਤਰੰਗੀ ਜ਼ਿੰਦਗੀ ਲਈ ਪ੍ਰੇਰਿਤ ਕਰਦਾ ਹੈ ਭੰਗੜੇ ਦੀ ਰਿਧਮ ਅਤੇ ਧੁੰਨ ਨਾਲ ਦਿਮਾਗ ਰਿਲੈਕਸ ਹੁੰਦਾ ਹੈ ਅਤੇ ਤੁਸੀਂ ਥੋੜ੍ਹਾ ਬਹੁਤ ਦਿਨ ਦੇ ਤਣਾਅ ਤੋਂ ਮੁਕਤ ਹੋ ਸਕਦੇ ਹੋ ਇਸ ਵਿੱਚ ਬਹੁਤ ਜ਼ਿਆਦਾ ਮੋਸ਼ਨ ਹੋਣ ਕਾਰਨ ਸਰੀਰ ਸਾਰਾ ਧਿਆਨ ਇਸ 'ਤੇ ਲਗਾ ਲੈਂਦਾ ਹੈ ਜਿਸ ਨਾਲ ਦਿਲ ਦਿਮਾਗ ਅਤੇ ਸਰੀਰ ਦਾ ਸਮਤੋਲ ਬਣਿਆ ਰਹਿੰਦਾ ਹੈ ਐਰੋਬਿਕਸ ਦੀ ਗੱਲ ਕਰੀਏ ਐਰੋਬਿਕਸ ਵੀ ਸਰੀਰ ਅਤੇ ਦਿਮਾਗ ਲਈ ਬਹੁਤ ਫਾਇਦਿਆਂ ਵਾਲੀ ਕਸਰਤ ਹੈ ਜਦੋਂ ਤੁਸੀਂ ਐਰੋਬਿਕਸ ਕਰਦੇ ਹੋ ਤਾਂ ਇਹ ਸਰੀਰ ਦੇ ਆਮ ਫੰਕਸ਼ਨ ਨੂੰ ਸੁਧਾਰਦਾ ਹੈ ਇਹ ਸਰੀਰ ਵਿੱਚ ਆਕਸੀਜਨ ਦਾ ਲੈਵਲ ਵਧਾਉਂਦਾ ਹੈ ਜਿਸ ਨਾਲ ਦਿਮਾਗ ਨੂੰ ਜ਼ਿਆਦਾ ਊਰਜਾ ਮਿਲਦੀ ਹੈ ਜਿਸ ਨਾਲ ਫੋਕਸ ਸ਼ਾਂਤ ਅਤੇ ਸਰੀਰਕ ਸਿਹਤ ਵਿੱਚ ਸੁਧਾਰ ਆਉਂਦਾ ਹੈ ਐਰੋਬਿਕਸ ਨੂੰ ਨਿਰੰਤਰ ਕਰਨ ਨਾਲ ਦਿਮਾਗ ਵਿੱਚ ਐਕਸਟੀਨ ਰਿਲੀਜ ਹੁੰਦੇ ਹਨ ਜੋ ਮਾਨਸਿਕ ਤਣਾਅ ਅਤੇ ਚਿੰਤਾ ਨੂੰ ਘਟਾਉਂਦੇ ਹਨ ਦੋਹਾਂ ਕਸਰਤਾਂ ਦਾ ਨਿੱਤ ਰੂਟੀਨ ਵਿੱਚ ਸ਼ਾਮਿਲ ਹੋਣਾ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਬਹੁਤ ਫਾਇਦਿਆਂ ਵਾਲਾ ਸਾਬਤ ਹੋ ਸਕਦਾ ਹੈ ਮੇਰੀ ਸਲਾਹ ਹੈ ਸਾਰਿਆਂ ਨੂੰ ਇਹਨਾਂ ਵਿੱਚੋਂ ਕੋਈ ਵੀ ਇੱਕ ਐਕਸਰਸਾਈਜ਼ ਤਾਂ ਜ਼ਰੂਰ ਕਰਨੀ ਚਾਹੀਦੀ ਆ